ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਤੁਹਾਡੀ ਕੈਬ ਬੁੱਕ ਕਰਵਾਈ ਸੀ ਜੀ ਪਰਸੋਂ ਚੰਡੀਗੜ੍ਹ ਜਾਣ ਲਈ ਮੈਨੂੰ ਬੇਹੱਦ ਅਫਸੋਸ ਹੋਇਆ ਤੁਹਾਡੀ ਕੈਬ ਨੂੰ ਬੁੱਕ ਕਰਵਾਉਣ ਤੋਂ ਬਾਅਦ ਕਿਉਂਕਿ ਤੁਹਾਡੀ ਜਿਹੜੀ ਸਰਵਿਸ ਸੀ ਉਸਨੂੰ ਮੈਂ ਵਧੀਆ ਨਹੀਂ ਮੰਨਾਂਗੀ ਕਿਉਂਕਿ ਇੱਕ ਤਾਂ ਬਿਲਕੁਲ ਵੀ ਸਾਫ਼ ਸਫ਼ਾਈ ਨਹੀਂ ਸੀ ਸੀਟਾਂ ਬਹੁਤ ਗੰਦੀਆਂ ਸੀ ਸਮੈੱਲ ਆ ਰਹੀ ਸੀ ਬਹੁਤ ਗੰਦੀ ਤਰ੍ਹਾਂ ਅਤੇ ਜਿਹੜਾ ਸਾਰਾ ਸਫ਼ਰ ਸੀ ਸਾਡਾ ਉਹ ਅਸੁਖਾਵਾਂ ਬੀਤਿਆ ਅਸੀਂ ਕੋਈ ਬਹੁਤਾ ਵਧੀਆ ਸਫ਼ਰ ਇਸ ਨੂੰ ਨਹੀਂ ਕਵਾਂਗੇ ਅਤੇ ਸਭ ਤੋਂ ਵੱਡੀ ਜਿਹੜੀ ਗਲਤੀ ਸੀ ਤੁਹਾਡਾ ਜਿਹੜਾ ਡਰਾਈਵਰ ਸੀ ਉਹਨੇ ਮਾਸਕ ਨਹੀਂ ਸੀ ਪਾਇਆ ਹੋਇਆ ਕੋਵਿਡ ਦਾ ਸਮਾਂ ਲੰਘ ਕੇ ਚੁੱਕਿਆ ਹੈ ਤਾਂ ਇਸ ਕਿਸਮ ਦੀ ਸਮੱਸਿਆ ਆ ਸਕਦੀ ਹੈ ਔਰ ਉਸਨੂੰ ਖਾਂਸੀ ਬਹੁਤ ਜ਼ਿਆਦਾ ਸੀ ਅਤੇ ਉਸਦੀ ਆਵਾਜ਼ ਵੀ ਕੁਛ ਜਿਹੜੀ ਹੈ ਉਹ ਸੁਖਾਵੀ ਨਹੀਂ ਸੀਗੀ ਰੁੱਖਾਪਣ ਸੀ ਉਸਦੀ ਬੋਲੀ ਦੇ ਵਿੱਚ ਤਾਂ ਮੈਨੂੰ ਬਹੁਤ ਅਟਪਟਾ ਲੱਗਿਆ ਇਹ ਸਭ ਕੁਛ ਦੇਖ ਕੇ ਕਿ ਸਾਨੂੰ ਇਹ ਸੀ ਕਿ ਤੁਹਾਡੀ ਕੈਬ ਦੇ ਵਿੱਚ ਸਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ ਪਰ ਐਨੀਆਂ ਦਿੱਕਤਾਂ ਇਸ ਕੈਬ ਦੇ ਵਿੱਚ ਅਸੀਂ ਮਹਿਸੂਸ ਕੀਤੀਆਂ ਤਾਂ ਬੜਾ ਅਫਸੋਸ ਰਿਹਾ ਸਾਨੂੰ ਤੁਹਾਡੇ ਨਾਲ ਤੁਹਾਡੀ ਏਜੰਸੀ ਦੀ ਇਸ ਕੈਬ ਨੂੰ ਬੁੱਕ ਕਰਕੇ ਸੋ ਅੱਗੇ ਤੋਂ ਧਿਆਨ ਰੱਖੋ ਕਿ ਕਿਸੇ ਹੋਰ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਆਪਣੀਆਂ ਕੈਬ ਨੂੰ ਸਾਫ਼ ਸੁਥਰੀਆਂ ਬਣਾਓ ਆਪਣੇ ਡਰਾਈਵਰ ਨੂੰ ਉਚਿੱਤ ਜਿਹੜੀ ਹੈ ਟ੍ਰੇਨਿੰਗ ਦਿਓ ਤਾਂ ਕਿ ਕਿਸੇ ਵੀ ਸਫ਼ਰ ਕਰਨ ਵਾਲੇ ਵਿਅਕਤੀ ਨੂੰ ਕਿਸੇ ਅਣਸੁਖਾਵੀ ਘਟਨਾ ਜਾਂ ਅਨਸੁਖਾਵੇ ਤਰੀਕੇ ਨਾਲ ਜੂਝਣਾ ਨਾ ਪਵੇ ਮੈਨੂੰ ਉਮੀਦ ਹੈ ਕਿ ਮੇਰੀ ਕੀਤੀ ਇਸ ਸ਼ਿਕਾਇਤ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਸੁਣੋਗੇ ਸਮਝੋਗੇ ਅਤੇ ਇਸ 'ਤੇ ਬਣਦੀ ਕਾਰਵਾਈ ਕਰਕੇ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਕਰੋਂਗੇ